ਖੇਤੀ ਮੈਨੂਰਲ ਅਤੇ ਮਸ਼ੀਨੀ ਤੌਰ 'ਤੇ ਕੀਤੀ ਜਾਂਦੀ ਹੈ ਜਿਸ ਵਿੱਚ ਮੈਨੂਰਲ ਤੌਰ 'ਤੇ ਕਹੀ ਆਉਂਦੀ ਹੈ ਕਹੀ ਦਾ ਕੰਮ ਹੈ ਧਰਤੀ ਨੂੰ ਛੋਟੇ ਛੋਟੇ ਆਕਾਰ ਦੇ ਵਿੱਚ ਪੁੱਟ ਕੇ ਉਸ ਨੂੰ ਸਰੀਰਕ ਤੌਰ 'ਤੇ ਪੁੱਟਿਆ ਜਾਂਦਾ ਹੈ ਨੰਬਰ ਦੋ 'ਤੇ ਖੁਰਪਾ ਆਉਂਦਾ ਹੈ ਖੁਰਪੇ ਨੂੰ ਬੈਠ ਕੇ ਜੋ ਧਰਤੀ ਦੇ ਵਿੱਚੋਂ ਖੱਬਲ ਕੱਢਣੇ ਹੁੰਦੇ ਹਨ ਜਾਂ ਬੈਠ ਕੇ ਕੋਈ ਲੱਸਣ ਵਗੈਰਾ ਗੁੱਡਣਾ ਹੁੰਦਾ ਹੈ ਖੁਰਪਾ ਇਹ ਉਸ ਦੇ ਕੰਮ ਆਉਂਦਾ ਹੈ ਅੱਗੇ ਦਾਤੀ ਆਉਂਦੀ ਹੈ ਦਾਤੀ ਜੋ ਬਰਸੀਨ ਹੈ ਜਾਂ ਬਾਜਰਾ ਹੈ ਉਸਨੂੰ ਬੈਠ ਕੇ ਵੱਢਣ ਦੇ ਕੰਮ ਆਉਂਦੀ ਹੈ ਦਾਤ ਦਾਤ ਆਪਾਂ ਖੜ੍ਹ ਕੇ ਬਰਸੀਨ ਵੱਢਦੇ ਹਾਂ ਉਸ ਨੂੰ ਦਾਤ ਕਿਹਾ ਜਾਂਦਾ ਹੈ ਮਸ਼ੀਨਰੀ ਯੁੱਗ ਦੇ ਮੈਨੂਰਲ ਤੌਰ 'ਤੇ ਵਰਤੇ ਜਾਣ ਵਾਲੇ ਸੰਦਾਂ ਦੇ ਵਿੱਚ ਇਹ ਸੰਦ ਆਉਂਦੇ ਹਨ ਉਸ ਤੋਂ ਅੱਗੇ ਮਸ਼ੀਨਰੀ ਯੁੱਗ ਜੋ ਮਸ਼ੀਨੀ ਯੁੱਗ ਹੈ ਅੱਜ ਦਾ ਉਸ ਵਿੱਚ ਟਰੈਕਟਰ ਮੇਨ ਪਾਰਟ ਟਰੈਕਟਰ ਹੈ ਟਰੈਕਟਰ ਬਹੁਤ ਤਰ੍ਹਾਂ ਦੇ ਆਉਂਦੇ ਹਨ ਜਿਸ ਤਰ੍ਹਾਂ ਕੋਈ ਜ਼ਿਆਦਾ ਖੇਤੀ ਕਰਨ ਵਾਲਾ ਹੈ ਉਸ ਨੂੰ ਜ਼ਿਆਦਾ ਹੋਰਸਪਾਵਰ ਦਾ ਟਰੈਕਟਰ ਚਾਹੀਦਾ ਹੁੰਦਾ ਹੈ ਜੋ ਪੰਜ ਅਤੇ ਚਾਰ ਕਿਲ੍ਹਿਆਂ ਵਾਲੇ ਏਕੜ ਵਾਲੇ ਜੋ ਕਿਸਾਨ ਹੁੰਦੇ ਹਨ ਉਹਨਾਂ ਨੂੰ ਛੋਟੇ ਟਰੈਕਟਰਾਂ ਦੇ ਨਾਲ ਸਰ ਜਾਂਦਾ ਹੈ ਟਰੈਕਟਰ ਦੇ ਨਾਲ ਵਰਤੇ ਜਾਣ ਵਾਲੇ ਜੋ ਮਸ਼ੀਨਰੀ ਯੁੱਗ ਦੇ ਸੰਦ ਹਨ ਉਹ ਹਲ ਹਲ ਹਨ ਜੋ ਜਮੀਨ ਨੂੰ ਪੁੱਟਣ ਦੇ ਕੰਮ ਆਉਂਦੇ ਹਨ ਅਤੇ ਟਰਾਲੀ ਟਰਾਲੀ ਜੇਕਰ ਅਸੀਂ ਕੋਈ ਢੋਆ ਢੁਆਈ ਦਾ ਕੰਮ ਕਰਦੇ ਹਾਂ ਜਾਂ ਖੇਤ ਦੇ ਵਿੱਚ ਪੈਣ ਵਾਲੀ ਜੋ ਖਾਦ ਹੈ ਉਸ ਨੂੰ ਵਰਤਣ ਲਈ ਅਸੀਂ ਟਰਾਲੀ ਦਾ ਅਤੇ ਹੋਰ ਵੀ ਕਈ ਕੰਮ ਟਰਾਲੀ ਦੇ ਨਾਲ ਲਏ ਜਾਂਦੇ ਹਨ ਉਸ ਤੋਂ ਬਾਅਦ ਸੁਹਾਗਾ ਸੁਹਾਗਾ ਉਸ ਸੰਦ ਨੂੰ ਕਿਹਾ ਜਾਂਦਾ ਹੈ ਜਦੋਂ ਮਸ਼ੀਨ ਨੂੰ ਆਪਣੇ ਧਰਤੀ ਨੂੰ ਸੁਆ ਆਪਣੇ ਧਰਤੀ ਨੂੰ ਹਲਾਂ ਦੇ ਰਾਹੀਂ ਪੁੱਟਿਆ ਜਾਂਦਾ ਹੈ ਉਸ ਨੂੰ ਬਿਲਕੁਲ ਸਾਫ ਅਤੇ ਪੱਧਰਾ ਕਰਨ ਦੇ ਲਈ ਆਪਾਂ ਨੂੰ ਸੁਹਾਗਾ ਵਰਤਦੇ ਹਾਂ ਉਹ ਤੋਂ ਅੱਗੇ ਆਉਂਦੇ ਹਨ ਜੀ ਰੋਟਾਵੀਟਰ ਰੋਟਾਵੀਟਰ ਹੈ ਜੋ ਆਪਣੇ ਕਣਕ ਬੀਜਣ ਦੇ ਹੁਣ ਆਧੁਨਿਕ ਯੁੱਗ ਦਾ ਜੋ ਸਾਧਨ ਹੈ ਉਸ ਦੇ ਨਾਲ ਅਸੀਂ ਰੋਟਾਵੀਟਰ ਦੇ ਨਾਲ ਕਰਾਹ ਕਰਾਹ ਜੋ ਧਰਤੀ ਨੂੰ ਪੱਧਰ ਕਰਨ ਦੇ ਕੰਮ ਆਉਂਦਾ ਹੈ